ਅ ਸਕੂਲ ਵਿੱਚ ਮੇਰੀ ਸਭ ਤੋਂ ਮਨਪਸੰਦੀਦਾ ਵਿਸ਼ਾ ਸੀ ਗਣਿਤ ਮੇਰੀ ਹੋਰ ਵੀ ਵਿਸ਼ਾ ਸੀਗੀਆਂ ਬਟ ਜੋ ਸਭ ਤੋਂ ਜ਼ਿਆਦਾ ਸਮੇਂ ਮੈਂ ਦਿੰਦਾ ਸੀਗਾ ਉਹ ਗਣਿਤ ਵਿਸ਼ੇ ਨੂੰ ਦਿੰਦਾ ਸੀਗਾ ਗਣਿਤ ਮੇਰੇ ਲਈ ਇੱਕ ਚੁਣੌਤੀ ਸੀ ਅਗਰ ਕੋਈ ਵੀ ਸਵਾਲ ਮੇਰੇ ਲਈ ਫਸ ਜਾਂਦਾ ਸੀਗਾ ਜਦ ਤੱਕ ਉਹਦਾ ਸਵਾਲ ਦਾ ਮੈਂ ਜਵਾਬ ਨਹੀਂ ਕੱਢ ਸਕਦਾ ਸੀਗਾ ਮੈਂ ਆਪਣਾ ਸਭ ਕੁਛ ਛੱਡ ਕੇ ਉਸ ਵਿੱਚ ਲੱਗਿਆ ਰਹਿੰਦਾ ਸੀਗਾ ਜਿਵੇਂ ਹੀ ਮੈਨੂੰ ਜਵਾਬ ਮਿਲਦਾ ਸੀਗਾ ਮੈਨੂੰ ਅੰਦਰੋਂ ਹੀ ਬਹੁਤ ਖੁਸ਼ੀ ਮਿਲਦੀ ਸੀ ਜਿਸ ਨਾਲ ਮੈਂ ਹੋਰ ਅੱਗੇ ਅੱਗੇ ਵੱਧਦਾ ਜਾਂਦਾ ਸੀਗਾ ਹੋਰ ਅੱਗੇ ਅੱਗੇ ਮੁਸ਼ਕਿਲ ਸਵਾਲ ਨੂੰ ਮੈਂ ਹੱਲ ਕਰਦਾ ਜਾਂਦਾ ਸੀਗਾ ਅੱਜ ਦੇ ਸਮੇਂ ਵੀ ਜਿਵੇਂ ਵੀ ਕੋਈ ਵੀ ਮੇਰੀ ਗਣਿਤ ਤੋਂ ਇਲਾਵਾ ਕੋਈ ਹੋਰ ਵੀ ਸਵਾਲ ਮੇਰੇ ਲਈ ਫਸਦਾ ਸੀਗਾ ਜਦ ਤੱਕ ਮੈਂ ਉਸ ਸਵਾਲ ਦਾ ਜਵਾਬ ਨਹੀਂ ਕੱਢ ਸਕਦਾ ਉਹ ਮੈਂ ਲੱਗਿਆ ਰਹਿੰਦਾ ਸੀਗਾ ਮੈਂ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਵੀ ਆਪਣੇ ਗਣਿਤ ਗਣਿਤ ਨੂੰ ਨਾਲ ਲੈ ਕੇ ਹੀ ਚੱਲਦਾ ਹਾਂ ਹਰ ਚੀਜ਼ ਦੀ ਮੈਂ ਕਟੌਤੀ ਗਣੌਤੀ ਨਾਲ ਨਾਲ ਕਰਦਾ ਰਹਿੰਦਾ ਹਾਂ ਜਿਸ ਕਰਕੇ ਮੇਰਾ ਇਹ ਵਿਸ਼ਾ ਸਭ ਤੋਂ ਮਨਪਸੰਦੀਦਾ ਹੈ